ਭਾਰਤ ਤਿਉਹਾਰਾਂ ਦਾ ਦੇਸ਼ ਹੈ ਜਿੱਥੇ ਇੱਥੇ ਬਹੁਤ ਸਾਰੇ ਤਿਉਹਾਰ ਜਿਵੇਂ ਲੋਹੜੀ ਰੱਖੜੀ ਦੀਵਾਲੀ ਰਾਮਨੌਮੀ ਜਨਮ ਜਨਮ ਅਸ਼ਟਮੀ ਗੁਰਪੁਰਬ ਆਦਿ ਮਨਾਏ ਜਾਂਦੇ ਹਨ ਦੀਵਾਲੀ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ ਇਹ ਤਿਉਹਾਰ ਹੈ ਕੱਤਕ ਦੀ ਮੱਸਿਆ ਨੂੰ ਸਾਰੇ ਭਾਰਤ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਦੀਵਾਲੀ ਦੁਸ਼ਹਿਰੇ ਤੋਂ ਵੀਹ ਦਿਨ ਬਾਅਦ ਆਉਂਦੀ ਹੈ ਦੀਵਾਲੀ ਮਨਾਉਣ ਦਾ ਵੀ ਪਿਛੋਕੜ ਦੀਵਾਲੀ ਮਨਾਉਣ ਦੇ ਕੁਝ ਕਾਰਨ ਹਨ ਹਿੰਦੂ ਇਸ ਨੂੰ ਇਸ ਲਈ ਮਨਾਉਂਦੇ ਹਨ ਕਿਉਂਕਿ ਇਸ ਦਿਨ ਸ਼੍ਰੀ ਰਾਮ ਚੰਦਰ ਜੀ ਲੰਕਾ ਦੇ ਰਾਜੇ ਰਾਵਣ ਨੂੰ ਮਾਰ ਕੇ ਸੀਤਾ ਸਮੇਤ ਉਹ ਸਮੇਤ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਲੋਕਾਂ ਦੇ ਰਾਜੇ ਰਾਵਣ ਨੂੰ ਮਾਰ ਕੇ ਸੀਤਾ ਮਾਤਾ ਸਮੇਤ ਚੌਦਾਂ ਸਾਲਾਂ ਆ ਆਏ ਸਨ ਆਏ ਸਨ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਲੋਕਾਂ ਨੇ ਦੀਪਮਾਲਾ ਕੀਤੀ